ਭਾਰਤੀ ਮੀਡੀਆ ਬਾਰੇ ਗੱਲ ਕਰੀਏ ਤਾਂ ਅੱਜ ਕੱਲ੍ਹ ਮੀਡੀਆ ਵਾਲਿਆਂ ਦੇ ਹਾਲਤ ਬਹੁਤ ਹੀ ਖ਼ਰਾਬ ਹੋ ਚੁੱਕੀ ਹੈ ਕਿਉਂਕਿ ਜੋ ਨਿਊਜ਼ ਹੈ ਅੱਜ ਕੱਲ੍ਹ ਪੈਸੇ ਦੇ ਕੇ ਨਿਊਜ਼ ਬਣਾਈ ਜਾਂਦੀ ਹੈ ਮੇਨ ਮੁੱਦੇ ਹੈ ਜਿਹੜੇ ਉਹਨਾਂ 'ਤੇ ਅਵਾਜ਼ ਨਹੀਂ ਉਠਾਈ ਜਾਂਦੀ ਅੱਜ ਕੱਲ਼੍ਹ ਇੰਸਟਾਗ੍ਰਾਮ ਟਿੱਕਟੋਕ ਰੀਲਜ਼ ਇਹਨਾਂ ਦੇ ਉੱਤੇ ਨਿਊਜ਼ ਬਣਦੀ ਹੈ ਬਟ ਜੋ ਮੇਨ ਮੁੱਦੇ ਜਿਵੇਂ ਲੜਕੀਆਂ ਨਾਲ਼ ਕਿਵੇਂ ਵਿਵਹਾਰ ਕੀਤਾ ਜਾਂਦਾ ਹੈ ਮਨੀਪੁਰ ਵਾਲਾ ਕਿੱਸਾ ਲੈ ਲਉ ਉਸ ਉੱਤੇ ਹਜੇ ਤੱਕ ਕੋਈ ਅਵਾਜ਼ ਨਹੀਂ ਉਠਾਈ ਜਾਂਦੀ ਅਤੇ ਬਾਕੀ ਜੇ ਅਖ਼ਬਾਰਾਂ ਦੀ ਗੱਲ ਕਰੀਏ ਤਾਂ ਅੱਜ ਅੱਜ ਦੇ ਟਾਈਮ 'ਚ ਸਿਰਫ਼ ਅਜੀਤ ਅਖ਼ਬਾਰ ਹੀ ਹੈ ਜਿਸ 'ਚ ਆਪਾਂ ਕੋਈ ਸੈਂਸੀਵਲ ਨਿਊਜ਼ ਪੜ੍ਹ ਸਕਦੇ ਹਾਂ ਬਾਕੀ ਤਾਂ ਭੱਠਾ ਹੀ ਬੈਠਿਆ ਹੋਇਆ ਹੈ